ਸੂਚਨਾ ਟੈਕਨੋਲੋਜੀ ਦੇ ਸਿੱਖਣ ਅਤੇ ਸਿੱਖਿਅਤ ਕਰਨ ਦੇ ਤਰੀਕੇ ਨੂੰ ਬਹੁਤ ਬਦਲ ਦਿੱਤਾ ਗਿਆ ਹੈ ਸੂਚਨਾ ਤਕਨੋਲੋਜੀ ਦੀ ਵਰਤੋਂ ਕਰਕੇ ਸਿੱਖਣ ਦੇ ਨਤੀਜੇ ਬਿਤਾਏ ਜਾ ਸਕਦੇ ਹਨ ਸੂਚਨਾ ਤਕਨੋਲੋਜੀ ਦੀ ਵਰਤੋਂ ਕਰਕੇ ਸਿੱਖਿਆ ਪ੍ਰਬੰਧਨ ਸਿਸਟਮ ਬਣਾਏ ਜਾ ਸਕਦੇ ਹਨ ਸੂਚਨਾ ਤਕਨੋਲੋਜੀ ਦੀ ਵਰਤੋਂ ਕਰਕੇ ਸਿੱਖਿਆ ਪ੍ਰਾਪਤ ਕਰਨ ਦੇ ਤਰੀਕੇ ਬਦਲ ਗਏ ਹਨ ਸੂਚਨਾ ਤਕਨੋਲੋਜੀ ਦੀ ਵਰਤੋਂ ਕਰਕੇ ਸਿੱਖਿਆ ਪ੍ਰਾਪਤ ਕਰਨ ਦੇ ਨਤੀਜੇ ਵਧਾਏ ਜਾ ਸਕਦੇ ਹਨ ਅਤੇ ਇਸ ਦੇ ਕਾਰਨ ਤਰੀਕੇ ਡਿਜੀਟਲ ਵੀ ਹੋ ਗਏ ਹਨ ਸੂਚਨਾ ਤਕਨੋਲੋਜੀ ਦੀ ਵਰਤੋਂ ਕਰਕੇ ਸਿੱਖਿਆ ਪ੍ਰਾਪਤ ਕਰਨ ਦੇ ਤਰੀਕੇ ਯੋਗਤਾ ਅਧਾਰਿਤ ਹੋ ਗਏ ਹਨ ਸੂਚਨਾ ਤਕਨੋਲੋਜੀ ਦੀ ਵਰਤੋਂ ਕਰਕੇ ਸਿੱਖਿਆ ਪ੍ਰਾਪਤ ਕਰਨ ਦੇ ਤਰੀਕੇ ਡਿਜੀਟਲ ਟ੍ਰਾਂਸਫਾਰਮ ਹੋ ਗਏ ਹਨ